ਹਾਂਜੀ ਮੈਂ ਰੋਪੜ ਬਾਰੇ ਜਾਣਦੀ ਹਾਂ ਅਤੇ ਮੈਂ ਰੋਪੜ ਦੇ ਬਾਰੇ ਤੁਹਾਨੂੰ ਵਿਸਥਾਰ ਪੂਰਵਕ ਦੱਸ ਸਕਦੀ ਹਾਂ ਅਤੇ ਰੋਪੜ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦੇ ਆ ਆਈਲੈਸ ਸੈਂਟਰ ਆਈਲੈਸ ਸੈਂਟਰ ਜਿਵੇਂ ਕਿ ਨਰਿੰਦਰ ਸੈਂਟਰ ਆਈਲੈਸ ਸੈਂਟਰ ਹੋ ਗਿਆ ਉਰੇ ਚੇਤੰਨਿਆ ਆਈਲੈਸ ਸੈਂਟਰ ਹੋ ਗਿਆ ਅਤੇ ਗਰੇਅ ਮੈਟਰ ਆਈਲੈਸ ਸੈਂਟਰ ਹੋ ਗਿਆ ਐੱਮ ਡੀ ਓਵਰਸੀਜ਼ ਜਾਂ ਜ਼ੈਲ ਸਿੰਘ ਕਲੋਨੀ ਆਈਲੈਸ ਸੈਂਟਰ ਹੋ ਗਿਆ ਅਤੇ ਇਹ ਸਾਰੇ ਹੀ ਆਈਲੈਸ ਸੈਂਟਰ ਦੇ ਵਿੱਚ ਬਹੁਤ ਹੀ ਵਧੀਆ ਪੜ੍ਹਾਈ ਸ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਕੀ ਕਰਨਾ ਹੈ ਕਿਸ ਤਰ੍ਹਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਨੀ ਹੈ ਕਿਸ ਤਰ੍ਹਾਂ ਲੋਕਾਂ ਨਾਲ ਅਸੀਂ ਆਈ ਕੌਨਟੈਕਟ ਬਣਾਉਣਾ ਕਿਸ ਤਰ੍ਹਾਂ ਅਸੀਂ ਲੋਕਾਂ ਨੂੰ ਆਪਣੀ ਇੰਟਰੋਡਕਸ਼ਨ ਦੇ ਸਕਦੇ ਹਾਂ ਅਤੇ ਦੂਸਰੇ ਨੰਬਰ 'ਤੇ ਸਾਡਾ ਕੋਲਿਜ ਆ ਗਿਆ ਰੋਪੜ ਦੇ ਵਿੱਚ ਬਹੁਤ ਹੀ ਬਹੁਤ ਸਾਰੇ ਕੋਲਜਿਜ ਹੈ ਜਿੱਥੇ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਜਿਵੇਂ ਕਿ ਰਿਆਤ ਕੋਲਿਜ ਹੋ ਗਿਆ ਖਾਲਸਾ ਕੋਲਿਜ ਹੋ ਗਿਆ ਅਤੇ ਗੌਰਮਿੰਟ ਕੋਲਿਜ ਹੋ ਗਿਆ ਇਹ ਸਾਰੇ ਹੀ ਕੋਲਜਿਜ਼ ਦੇ ਵਿੱਚ ਬਹੁਤ ਹੀ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਅੱਗੇ ਆ ਗਿਆ ਸਕੂਲ ਸਕੂਲ ਦੇ ਵਿੱਚ ਸਾਨੂੰ ਸਕੂਲ ਰੋਪੜ ਦੇ ਵਿੱਚ ਬਹੁਤ ਹੀ ਜਗ੍ਹਾ 'ਤੇ ਹਨ ਜਿਵੇਂ ਕਿ ਗੌਰਮਿੰਟ ਗਰਲਜ਼ ਸਕੂਲ ਹੋ ਗਿਆ ਐੱਸ ਜੀ ਹਾਈ ਸਕੂਲ ਹੋ ਗਿਆ ਖਾਲਸਾ ਸਕੂਲ ਹੋ ਗਿਆ ਗਾਂਧੀ ਸਕੂਲ ਹੋ ਗਿਆ ਅਤੇ ਖਾਲਸਾ ਸਕੂਲ ਗਾਂਧੀ ਸਕੂਲ ਇਹ ਸਾਰੇ ਕੋਲਜਿਜ਼ ਬਹੁਤ ਹੀ ਵਧੀਆ ਹਨ ਅਤੇ ਇਹ ਕੋਲ ਇਹ ਸਕੂਲਜ਼ ਦੇ ਨਾਲ ਹੀ ਕਿਡਜ਼ ਸਕੂਲ ਵੀ ਬਹੁਤ ਸਾਰੇ ਸ ਰੋਪੜ ਦੇ ਵਿੱਚ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਬਹੁਤ ਹੀ ਵਧੀਆ ਪੜ੍ਹਾਈ ਦਿੱਤੀ ਜਾਂਦੀ ਹੈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਨੀ ਹੈ ਬਹਿਣਾ ਹੈ ਉਨ੍ਹਾਂ ਨੂੰ ਡਿਸਿਪਲਨ ਬਾਰੇ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਜੋ ਵੀ ਉਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਕਰਨਾ ਹੈ ਉਨ੍ਹਾਂ ਦੇ ਏਮ ਹੈ ਉਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਤੋਂ ਹੀ ਚੁਆਇਸ ਕਰ ਲਉ ਕਿ ਤੁਸੀਂ ਅੱਗੇ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਬਾਰਵੀਂ ਤੋਂ ਬਾਅਦ ਬੱਚਿਆਂ ਨੂੰ ਬਹੁਤ ਹੀ ਔਖੀ ਹੁੰਦੀ ਹੈ ਇਹ ਚੂਜ਼ ਕਰਨ ਦੇ ਵਿੱਚ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਹੈ ਸਪੋਰਟਸ ਅਕੈਡਮੀ ਅੱਗੇ ਹੈ ਸਾਡਾ ਸਪੋਰਟਸ ਅਕੈਡਮੀ ਸਪੋਰਟਸ ਅਕੈਡਮੀ ਜਿਵੇਂ ਕਿ ਖਾਲ ਖਾਲਸਾ ਸਟੇਡੀਅਮ ਹੋ ਗਿਆ ਨਹਿਰੂ ਸਟੇਡੀਅਮ ਹੋ ਗਿਆ ਡੀ ਏ ਵੀ ਸਟੇਡੀਅਮ ਹੋ ਗਿਆ ਇਹ ਸਾਰੇ ਸਟੇਡੀਅਮਸ 'ਤੇ ਗੇਮਜ਼ ਉਪਲਬਧ ਹੁੰਦੀਆਂ ਹਨ ਅਤੇ ਸ਼ਾਮ ਦੇ ਟਾਈਮ ਦੇ ਵਿੱਚ ਬੱਚੇ ਇੱਥੇ ਆ ਕੇ ਗੇਮਜ਼ ਖੇਡਦੇ ਹਨ ਅਤੇ ਸਵੇਰ ਦੇ ਟਾਈਮ ਦੇ ਵਿੱਚ ਵੀ ਬੱਚੇ ਇੱਥੇ ਆਉਂਦੇ ਹਨ ਲੋਕ ਇੱਥੇ ਆਉਂਦੇ ਹਨ ਰਨਿੰਗ ਕਰਦੇ ਹਨ ਸਾਈਕਲਿੰਗ ਕਰਦੇ ਹਨ ਗੇਮਜ਼ ਖੇਡਦੇ ਹਨ ਅਤੇ ਇੱਥੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਅੱਗੇ ਗੁਰਦੁਆਰਾ ਸਾਹਿਬ ਇੱਥੇ ਰੋਪੜ ਵਿੱਚ ਇੱਕ ਬਹੁਤ ਹੀ ਫੇਮਸ ਗੁਰਦੁਆਰਾ ਸਾਹਿਬ ਹੈ ਜੋ ਸਤਲੁਜ ਰੀਵਰ ਦੇ ਨਾਲ ਹੀ ਵਸਿਆ ਹੋਇਆ ਹੈ ਜੋ ਸਤਲੁਜ ਰੀਵਰ ਦੇ ਕਿਨਾਰੇ ਵਸਿਆ ਹੋਇਆ ਹੈ ਅਤੇ ਇੱਥੇ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਇੱਥੇ ਸਵੇਰੇ ਸਵੇਰੇ ਦਾ ਮੌਸਮ ਹੈ ਬਹੁਤ ਹੀ ਅੱਛਾ ਹੁੰਦਾ ਹੈ ਅਤੇ ਇੱਥੇ ਅਤੇ ਇੱਥੇ ਐਕਟਰ ਐਕਟਰਸ ਵੀ ਆਉਂਦੇ ਹਨ ਐਕਟਰੇਸਿਸ ਵੀ ਆਉਂਦੀਆਂ ਹਨ ਅਤੇ ਬਹੁਤ ਸਾਰੇ ਦੂਰ ਦੂਰ ਤੋਂ ਲੋਕ ਆਉਂਦੇ ਹਨ ਮੱਥਾ ਟੇਕਣ ਦੇ ਲਈ ਅਤੇ ਨਾਲ ਹੀ ਇੱਥੇ ਗੁਰਦੁਆਰੇ ਦੇ ਵਿੱਚ ਬਹੁਤ ਹੀ ਵਧੀਆ ਸਾਨੂੰ ਫੀਲ ਹੁੰਦੇ ਹੈ ਅੱਗੇ ਹੋਸਪਿਟਲ ਹੋਸਪਿਟਲਜ਼ ਇੱਥੇ ਪਰਮਾਰ ਹੋਸਪਿਟਲ ਹੋ ਗਿਆ ਸੋਹਾਣਾ ਹੋਸਪਿਟਲ ਹੋ ਗਿਆ ਵੇਰੰਤਾ ਹੋਸਪਿਟਲ ਹੋ ਗਿਆ ਪਰਮਾਰ ਹੋਸਪਿਟਲ ਇੱਥੇ ਬਹੁਤ ਹੀ ਵਧੀਆ ਹੋਸਪਿਟਲਜ਼ ਹਨ ਸਿਵਲ ਹੋਸਪਿਟਲ ਅਤੇ ਇਨ੍ਹਾਂ ਸਾਰੇ ਹੋਸਪਿਟਲਜ਼ ਦੇ ਵਿੱਚ ਵਧੀਆ ਵਧੀਆ ਸੇਵਾ ਦਿੱਤੀ ਜਾਂਦੀ ਹੈ ਅਤੇ ਇੱਥੇ ਬਹੁਤ ਹੀ ਸਾਰੀਆਂ ਸਾਨੂੰ ਪ੍ਰੋਵਾਈਡਜ਼ ਹੋ ਗਈਆਂ ਹਨ ਚੀਜ਼ਾਂ ਜਿਹਦੇ ਨਾਲ ਅਸੀਂ ਇੱਥੇ ਬਹੁਤ ਸਾਰੀਆਂ ਮਸ਼ੀਨਜ਼ ਵੀ ਪ੍ਰੋਵਾਈਡ ਹੋ ਗਈਆਂ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਇਲਾਜ ਆਰਾਮ ਨਾਲ ਕਰਵਾ ਸਕਦੇ ਹਾਂ ਆਈ ਆਈ ਟੀ ਰੋਪੜ ਆਈ ਆਈ ਟੀ ਰੋਪੜ ਦੇ ਵਿੱਚ ਬਹੁਤ ਸਾਰੇ ਬੱਚੇੇ ਆ ਜਿਹੜੇ ਦੂਰ ਦੂਰ ਤੋਂ ਪੜ੍ਹਾਈ ਕਰਨ ਦੇ ਲਈ ਆਉਂਦੇ ਹਨ ਇੱਥੇ ਹਰ ਇੱਕ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਹਰ ਇੱਕ ਤਰ੍ਹਾਂ ਦੀ ਸਾਨੂੰ ਥੀਮਜ਼ ਹੈ ਉਹ ਦਿੱਤੀ ਜਾਂਦੀ ਹੈ ਸਾਨੂੰ ਸਿਖਲਾਈ ਕੀਤੀ ਜਾਂਦੀ ਹੈ ਪਲੱਸ ਫਿਰ ਇੱਥੇ ਆਈ ਟੀ ਆਈ ਕਰਨ ਤੋਂ ਬਾਅਦ ਅਸੀਂ ਵਧੀਆ ਤੋਂ ਵਧੀਆ ਜੋਬਜ਼ 'ਤੇ ਲੱਗ ਸਕਦੇ ਹਾਂ ਅੱਗੇ ਆਈ ਟੀ ਆਈ ਆਈ ਟੀ ਆਈ ਵੂਮੈਨ ਰੂਪਨਗਰ ਆਈ ਟੀ ਆਈ ਵੂਮੈਨ ਰੂਪਨਗਰ ਦੇ ਵਿੱਚ ਸਾਨੂੰ ਕੰਪਿਊਟਰ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਕੰਪਿਊਟਰ ਸਿਲਾਈ ਬਿਊਟੀਸ਼ੀਅਨ ਅਤੇ ਕਢਾਈ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਇਨ੍ਹਾਂ ਵਿੱਚੋਂ ਸਾਨੂੰ ਇੱਕ ਸਬਜੈਕਟ ਬਾਰੇ ਸਿਖਾਇਆ ਜਾਂਦਾ ਹੈ ਜੇਕਰ ਅਸੀਂ ਕੰਪਿਊਟਰ ਦਾ ਕਰਦੇ ਹਾਂ ਅਤੇ ਕੰਪਿਊਟਰ ਦੇ ਵਿੱਚ ਸਾਨੂੰ ਹਰ ਇੱਕ ਚੀਜ਼ ਬੜੇ ਧਿਆਨ ਨਾਲ ਦੱਸੀ ਜਾਂਦੀ ਹੈ ਅਤੇ ਇਹ ਸਾਲ ਦਾ ਕੋਰਸ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਇਗਜ਼ਾਮ ਦੇਣ ਤੋਂ ਬਾਅਦ ਸਾਨੂੰ ਜੋਬਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ ਸਿਲਾਈ ਸਿਲਾਈ ਦੇ ਵਿੱਚ ਅਸੀਂ ਸਿਲਾਈ ਸਿਲਾਈ ਦੇ ਵਿੱਚ ਅਸੀਂ ਸਾਲ ਦਾ ਕੋਰਸ ਕਰਨ ਤੋਂ ਬਾਅਦ ਸਾਨੂੰ ਜੋਬਜ਼ ਪ੍ਰੋਵਾਈਡ ਹੁੰਦੀ ਹੈ ਔਰ ਬਿਊਟੀਸ਼ੀਅਨ ਦੇ ਵਿੱਚ ਵੀ ਸਾਨੂੰ ਜੋਬਜ਼ ਪ੍ਰੋਵਾਈਡ ਹੁੰਦੀ ਹੈ ਇਲੈਕਟ੍ਰੀਸਿਟੀ ਇੱਥੇ ਹਰ ਇੱਕ ਤਰ੍ਹਾਂ ਦੀ ਇਲੈਕਟ੍ਰੀਸਿਟੀ ਉਪਲਬਧ ਹੈ ਅਤੇ ਜਿਵੇਂ ਕਿ ਮਸ਼ੀਨਜ਼ ਹੋ ਗਈਆਂ ਐੱਲ ਈ ਡੀ ਜ਼ ਹੋ ਗਈਆਂ ਔਰ ਐੱਲ ਈ ਡੀ ਜ਼ ਹੋ ਗਈਆਂ ਟੀ ਵੀ ਜ਼ ਹੋ ਗਏ ਅਤੇੇ ਇੱਥੇ ਸੜਕ ਵੀ ਬਹੁਤ ਹੀ ਵਧੀਆ ਤੌਰ 'ਤੇ ਬਣਾਈ ਗਈ ਹੈ ਅਤੇ ਇੱਥੇ ਜੋ ਬਾਰਿਸ਼ ਦਾ ਜੋ ਪਾਣੀ ਹੈ ਉਹ ਵੀ ਨਹੀਂ ਰੁਕਦਾ ਹੈਗਾ ਅਤੇ ਬਾਰਿਸ਼ ਦਾ ਪਾਣੀ ਨਹੀਂ ਰੁਕਦਾ ਅਤੇ ਇੱਥੇ ਗੰਦਗੀ ਨਹੀਂ ਹੈ ਅਤੇ ਜਿਹੜੀ ਗੰਦਗੀ ਹੈ ਉਸ ਨੂੰ ਸਾਫ ਕੀਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਫੈਕਟਰੀਜ਼ ਬਹੁਤ ਘੱਟ ਹੈ